ਮੈਂ ਜਦੋਂ ਵੀ ਕਿਤੇ ਘੁੰਮਣ ਜਾਂਦੀ ਹਾਂ ਤਾਂ ਮੈਂ ਸੋਚਦੀ ਹਾਂ ਕਿ ਹਰ ਇੱਕ ਮੂਵਮੈਂਟ ਨੂੰ ਮੈਂ ਆਪਣੇ ਕੈਮਰੇ ਦੇ ਵਿੱਚ ਕੈਪਚਰ ਕਰ ਲਵਾਂ ਉਸ ਤਰੀਕੇ ਨਾਲ ਮੈਂ ਇੱਕ ਵਾਰ ਟਰਿੱਪ 'ਤੇ ਗਈ ਸੀਗੀ ਆਪਣੇ ਕੋਲਜ ਟਰਿੱਪ ਦੇ ਵਿੱਚ ਗਈ ਸੀਗੀ ਆਪਣੇ ਫਰੈਂਡਸ ਦੇ ਨਾਲ ਅਤੇ ਮੈਂ ਮਨਾਲੀ ਘੁੰਮਣ ਲਈ ਗਈ ਸੀਗੀ ਤਾਂ ਮੈਂ ਆਪਣਾ ਇੱਕ ਬਹੁਤ ਛ ਛੋਟਾ ਜਿਹਾ ਕੈਮਰਾ ਲੈ ਕੇ ਗਈ ਸੀਗੀ ਅਤੇ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਫੋਟੋਜ਼ ਕਲਿੱਕ ਕੀਤੀਆਂ ਅਤੇ ਇੱਕ ਫੋਟੋ ਜਿਹੜੀ ਕਿ ਮੈਨੂੰ ਹੁਣ ਵੀ ਯਾਦ ਹੈ ਮੈਂ ਜਦੋਂ ਵੀ ਉਸ ਫੋਟੋ ਨੂੰ ਦੇਖਦੀ ਹਾਂ ਤਾਂ ਮੈਨੂੰ ਉਹ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਜਿਹੜੀਆਂ ਕਿ ਮੈਂ ਆਪਣੇ ਫਰੈਂਡਸ ਦੇ ਨਾਲ ਬਹੁਤ ਇੰਜੋਏ ਕੀਤਾ ਸੀਗਾ ਉਸ ਟਾਈਮ 'ਤੇ ਅਤੇ ਉਹਦੇ ਵਿੱਚ ਇੱਕ ਫੋਟੋ ਸੀਗੀ ਜਿਹੜੀ ਕਿ ਰੀਵਰ ਦੇ ਕੋਲ ਸੀਗੀ ਜਿਹੜੀ ਕਿ ਬਹੁਤ ਵਧੀਆ ਸੀਗੀ ਮੈਂ ਉਹ ਆਪਣੇ ਫਰੈਂਡਸ ਦੇ ਨਾਲ ਗਰੁੱਪ ਫੋਟੋ ਸੀਗੀ ਜਿਹਦੇ ਵਿੱਚ ਮੇਰੇ ਸਾਰੇ ਫਰੈਂਡ ਸੀਗੇ ਜਦੋਂ ਵੀ ਮੈਂ ਉਹ ਫੋਟੋ ਨੂੰ ਦੇਖਦੀ ਹਾਂ ਤਾਂ ਮੈਂ ਇੱਦਾਂ ਲੱਗਦਾ ਏ ਆ ਕਿ ਮੈਂ ਉਹ ਸਮੇਂ ਦੇ ਵਿੱਚ ਫੇਰ ਮੈਂ ਉੱਥੇ ਚਲੀ ਗਈ ਹਾਂ ਅਤੇ ਆਪਣੇ ਫਰੈਂਡਸ ਦੇ ਨਾਲ ਉਹੀ ਮੂਵਮੈਂਟ ਨੂੰ ਇੰਜੋਏ ਕਰ ਰਹੀ ਹਾਂ